ਪੰਜਾਬ ਦੇ ਵਿੱਚ ਜਦ ਵੀ ਕਿਸੇ ਬੱਚੇ ਦਾ ਜਨਮ ਹੁੰਦਾ ਪਰਿਵਾਰ ਦੇ ਵਿੱਚ ਤਾਂ ਸਭ ਤੋਂ ਪਹਿਲਾ ਤਾਂ ਗੁਰੂਦੁਆਰਾ ਮੰਦਰ ਮਸਜਿਦ ਜਾ ਕੇ ਜਿਹੜਾ ਆ ਉਹ ਕੋਈ ਆਪਣਾ ਮਠਿਆਈ ਜਾਂ ਡੱਬਾ ਵਗੈਰਾ ਕੋਈ ਵੀ ਚੜ੍ਹਾਉਂਦੇ ਆ ਜਾ ਕੇ ਅਤੇ ਅਰਦਾਸ ਕਰਦੇ ਆ ਕਿ ਪਰਮਾਤਮਾ ਨੇ ਸਾਨੂੰ ਬੱਚੇ ਦੀ ਬਖਸ਼ਿਸ਼ ਦਿੱਤੀ ਅਤੇ ਉਹ ਤੋਂ ਬਾਅਦ ਜਦ ਉਹ ਫਿਰ ਉਹਦਾ ਨਾਮਕਰਨ ਕੀਤਾ ਜਾਂਦਾ ਨਾਮਕਰਨ ਦੇ ਕਰਨ ਦੇ ਲਈ ਨਾਮਕਰਨ ਕਰਨ ਦੇ ਲਈ ਗੁਰਦੁਆਰਾ ਸਾਹਿਬ ਤੋਂ ਕਈ ਵਾਰੀ ਜਾਂ ਉਹਦਾ ਨਾਮਕਰਨ ਕਰਨ ਲਈ ਅੱਖਰ ਜਿਹੜਾ ਉਹ ਕਢਵਾਉਂਦੇ ਆ ਉਹਦਾ ਜਿਹੜਾ ਸ਼ਬਦ ਆ ਨਾਮ ਦਾ ਉਹ ਅੱਖਰ ਜਦ ਮਿ ਆਪਾਂ ਨੂੰ ਮਿਲ ਜਾਂਦਾ ਫੇਰ ਉਹ ਜਿਹੜਾ ਆਪਣੇ ਰਿਸ਼ਤੇਦਾਰ ਜਿਹੜੇ ਆ ਜਾਂ ਸਾਕ ਸੰਬੰਧੀ ਜਿੰਨੇ ਵੀ ਓਹ ਉਹਨਾਂ ਨੂੰ ਨਾਂ ਜਿਹੜਾ ਸੁਜੈਸਟ ਕਰਨ ਲਈ ਕਿਹਾ ਜਾਂਦਾ ਵੀ ਦੱਸੋ ਇਹ ਅੱਖਰ ਦੇ ਉੱਤੇ ਨਾਂ ਆਪਾਂ ਰੱਖਣਾ ਬੱਚੇ ਦਾ ਅਤੇ ਕੀ ਨਾਂ ਰੱਖਿਆ ਜਾਵੇ ਅਤੇ ਉਹ ਜਿਹੜਾ ਫੇਰ ਉਹਦਾ ਨਾਮਕਰਨ ਕੀਤਾ ਜਾਂਦਾ ਇੱਦਾਂ ਹੀ ਜਦ ਨਾਮਕਰਨ ਹੋ ਜਾਂਦਾ ਆ ਉਹਦੇ ਤੋਂ ਬਾਅਦ ਫੇਰ ਜਦ ਬੱਚਾ ਤੇਰ੍ਹਾਂ ਦਿਨਾਂ ਦਾ ਹੋ ਜਾਂਦਾ ਤੇਰ੍ਹਾਂ ਦਿਨਾਂ ਦਾ ਹੋਣ ਤੋਂ ਬਾਅਦ ਫੇਰ ਉਹ ਉਹਦੀ ਖੁਸ਼ੀ ਦੇ ਵਿੱਚ ਪਾਰਟੀ ਜਾਂ ਪ੍ਰੋਗਰਾਮ ਕੋਈ ਰੱਖਿਆ ਜਾਂਦਾ ਘਰ ਦੇ ਵਿੱਚ ਪ੍ਰੋਗਰਾਮ ਰੱਖ ਕੇ ਬਾਅਦ ਵਿੱਚ ਲੱਡੂ ਵਗੈਰਾ ਤਿਆਰ ਕੀਤੇ ਜਾਂਦੇ ਮਠਿਆਈ ਤਿਆਰ ਕੀਤੀ ਜਾਂਦੀ ਆ ਤਿਆਰ ਕਰਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਰਿਸ਼ਤੇਦਾਰਾਂ ਦੇ ਲੱਡੂ ਮਠਿਆਈ ਜਿਹੜੀ ਉਹ ਵੰਡੀ ਜਾਂਦੀ ਖੁਸ਼ੀ ਦੇ ਵਿੱਚ ਅਤੇ ਇਸੇ ਤਰ੍ਹਾਂ ਹੀ ਜਨਮ ਦਿਨ ਜਿਹੜਾ ਆ ਉਹ ਬਹੁਤ ਖੁਸ਼ੀ ਦੇ ਤਰੀਕੇ ਦੇ ਨਾਲ ਕੋਈ ਲੜਕਾ ਜਾਂ ਲੜਕੀ ਲਗਭਗ ਸਾਰਿਆਂ ਦਾ ਵਧੀਆ ਤਰੀਕੇ ਨਾਲ ਜਨਮਦਿਨ ਮਨਾਉਂਦੇ ਆ ਅਤੇ ਫਿਰ ਜਿਹੜਾ ਲੋਹੜੀ ਦਾ ਤਿਉਹਾਰ ਆਉਂਦਾ ਆ ਸਾਲ ਦੇ ਵਿੱਚ ਹਰੇਕ ਜਨਵਰੀ ਦੇ ਵਿੱਚ ਜਿਹੜਾ ਆ ਲੋਹੜੀ ਦਾ ਤਿਉਹਾਰ ਆਉਂਦਾ ਅਤੇ ਉਹਦੇ ਵਿੱਚ ਵੀ ਜਿਹੜਾ ਫਿਰ ਬਾਅਦ ਉਹਦੇ ਬੱਚੇ ਦੀ ਲੋਹੜੀ ਲਾਈ ਜਾਂਦੀ ਹੈ ਉਹਦੇ ਜਨਮ ਦੀ ਖੁਸ਼ੀ ਦੇ ਅੰਦਰ ਬੱਚੇ ਦਾ ਜਨਮ ਜਿਹੜਾ ਜਦੋਂ ਮਰਜ਼ੀ ਹੋਇਆ ਹੋਵੇ ਪਰ ਲੋਹੜੀ ਦੇ ਉੱਤੇ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਂਦਾ ਹੈ ਵੀ ਹਾਂ ਵੀ ਲੋਹੜੀ ਦੇ ਉੱਤੇ ਪਤਾ ਲੱਗੇ ਹਾਂ ਵੀ ਅਸੀਂ ਆਪਣੇ ਬੱਚੇ ਦੀ ਲੋਹੜੀ ਪਾਈ ਹੈ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੋ ਇਸੇ ਤਰ੍ਹਾਂ ਹੀ ਅਲੱਗ ਅਲੱਗ ਤਰੀਕੇ ਪੰਜਾਬ ਦੇ ਵਿੱਚ ਜਿਹੜਾ ਆ ਜਨਮ ਦਿਨ ਮਨਾਇਆ ਜਾਂਦਾ ਬੱਚਿਆ ਦਾ